ਹੈਲੋ ਹਾਂਜੀ ਨਮਸਕਾਰ ਹੈਲੋ ਹਾਂਜੀ ਹਾਂਜੀ ਬੱਚਿਆਂ ਦੀਆਂ ਬੁੱਕਾ ਮਿਲ ਜਾਣਗੀਆਂ ਜੀ ਕਿਹੜੀ ਕਲਾਸ ਦੀਆਂ ਜੀ ਫਿਫਥ ਕਲਾਸ ਦੀਆਂ ਮਿਲ ਜਾਣਗੀਆ ਜੀ ਕਿਹੜਾ ਸਬਜੈਕਟ ਜੀ ਹਾਂਜੀ ਹਾਂ ਸਾਰੀਆਂ ਸਾਰੀਆਂ ਮਿਲ ਜਾਣਗੀਆਂ ਜੀ ਜਦੋਂ ਮਰਜ਼ੀ ਆਓ ਬੁੱਕਾਂ ਤੋਂ ਬਿਨਾਂ ਸਾਡੇ ਕੋਲ ਬੈਗ ਸਟੇਸ਼ਨਰੀ ਪੈਨ ਪੈਨਸਲ ਰਬੜ ਸ਼ਾਪਨਰ ਕਲਰ ਔਰ ਜੋ ਵੀ ਸਮਾਨ ਤੁਹਾਨੂੰ ਚਾਹੀਦਾ ਉਹ ਸਾਰਾ ਕੁਝ ਮਿਲੂਗਾ ਜੀ ਠੀਕ ਹੈ ਜੀ ਹਾਂ ਹਾਂ ਇੰਗਲਿਸ਼ ਮੀਡੀਅਮ 'ਚ ਵੀ ਮਿਲ ਜਾਣਗੇ ਜੀ ਸਾਰਾ ਸੈਟ ਇੰਗਲਿਸ਼ ਮੀਡੀਅਮ 'ਚ ਦੇ ਦਾਂਗੇ ਜੀ ਹਾਂਜੀ ਹਾਂਜੀ ਜੇ ਤੁਸੀਂ ਇਕੱਠੀਆਂ ਲਾਓਗੇ ਜੀ ਦਰਜਨ ਆਪਾਂ ਕੁਝ ਰਿਆਤ ਕਰਦਿਆਂਗੇ ਜੀ ਤੇ ਬੁੱਕਾਂ ਦੇ ਨਾਲ ਤੁਹਾਨੂੰ ਕਵਰ ਹ ਜਿਹੜੇ ਉਹ ਫ੍ਰੀ ਦੇ ਦਿਆਂਗੇ ਜੀ ਹਾਂਜੀ ਤੇ ਹੋਰ ਵੀ ਜੇ ਕੋਈ ਸਟੇਸ਼ਨਰੀ ਦਾ ਸਮਾਨ ਲੈਨੇ ਹੋ ਤੁਸੀਂ ਕੋਈ ਵੀ ਪੈੱਨ ਪੈਨਸਿਲ ਬੈਗ ਸਕੂਲ ਬੈਗ ਬੋਤਲ ਬੱਚਿਆਂ ਦਾ ਲੰਚ ਬੋਕਸ ਇਹ ਸਾਰਾ ਸਮਾਨ ਵੀ ਆਪਾਂ ਨੂੰ ਮਿਲ ਜਾਊਗਾ ਤੇ ਇਹ ਵੀ ਤੁਹਾਨੂੰ ਰਿਆਤੀ ਦਾ ਹਾਂ ਇਹਦੇ ਚ ਵੀ ਲੈੱਸ ਕਰਕੇ ਤੁਹਾਨੂੰ ਦੇ ਦਿਆਂਗੇ ਸਾਰਾ ਸਮਾਨ ਹੀ ਹੁੰਦਾ ਹਾਂਜੀ ਕੀ ਚੀਜ਼ ਜੀ ਹਾਂਜੀ ਹਾਂਜੀ ਹਾਂਜੀ ਹਾਂ ਸਪੋਰਟਸ ਦਾ ਸਮਾਨ ਵੀ ਆਪਣੇ ਕੋਲ ਹੁੰਦਾ ਜੀ ਨਾਲ ਕੋਈ ਵੀ ਸਪੋਰਟਸ ਦੀ ਜੇ ਬੱਚੇ ਕਿਸੇ ਵੀ ਐਕਟੀਵਿਟੀ 'ਚ ਭਾਗ ਲੈਂਦੇ ਉਹ ਸਾਰਾ ਸਮਾਨ ਆਪਣੇ ਕੋਲੇ ਮਿਲ ਜਾਂਦਾ ਜੀ ਅੱਛਾ ਜੀ ਹਾਂਜੀ ਹਾਂ ਤੁਸੀਂ ਉਹਦੀ ਹਾਂਜੀ ਲਿਸਟ ਬਣਵਾ ਲਿਆਇਓ ਜੀ ਜੋ ਵੀ ਲਿਸਟ 'ਚ ਥੋਡਾ ਸਮਾਨ ਲਿਖਿਆ ਹੋਊਗਾ ਜੋ ਵੀ ਕਿਤਾਬਾਂ ਜਾਂ ਸਟੇਸ਼ਨਰੀ ਸਾਰਾ ਕੁਛ ਏਥੋਂ ਮਿਲਜੇਗਾ ਜੀ ਠੀਕ ਐ ਓਕੇ ਜੀ ਠੀਕ